ਅੱਜ ਕੱਲ੍ਹ ਬੈਂਕਾਂ ਦੇ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਐਨਪੀਏ ਹੈ ਜਿਹਨੂੰ ਅਸੀਂ ਨੋਨ ਪਰਫੋਰਮਿੰਗ ਐਸਟ ਵੀ ਕਹਿ ਦਿੰਦੇ ਹਾਂ ਬੈਂਕ ਲੋਨ ਦੇ ਰੂਪ ਵਿੱਚ ਕੁਝ ਪੈਸੇ ਜਦੋਂ ਲੋਕਾਂ ਨੂੰ ਦਿੰਦੇ ਹਨ ਤਾਂ ਲੋਕ ਉਹ ਪੈਸਾ ਵਾਪਸ ਨਹੀਂ ਕਰਦੇ ਜਿਸ ਕਾਰਨ ਬੈਂਕਾਂ ਦੀ ਮਾਲੀ ਹਾਲਤ ਬਹੁਤ ਵਿਗੜ ਰਹੀ ਹੈ ਅਤੇ ਵੱਡੇ ਵੱਡੇ ਬੈਂਕ ਵੀ ਬੰਦ ਹੋਣ ਦੀ ਕਗਾਰ 'ਤੇ ਹਨ ਅਤੇ ਦੂਜਾ ਦੂਜੀ ਚੁਣੌਤੀ ਜਿਹੜੀ ਹੈ ਉਹ ਹੈ ਡਿਜੀਟਲ ਧੋਖਾਧੜੀ ਅੱਜ ਕੱਲ੍ਹ ਬੈਂਕ ਦੇ ਸਾਰੇ ਕੰਮ ਆਨਲਾਈਨ ਹੋਣ ਕਰਕੇ ਲੋਕਾਂ ਨਾਲ ਸਾਈਬਰ ਧੋਖਾਧੜੀ ਦਾ ਖਤਰਾ ਵੱਧ ਗਿਆ ਹੈ ਲੋਕ ਅੱਜ ਕੱਲ੍ਹ ਆਨਲਾਈਨ ਟ੍ਰਾਂਸਫਰ ਕਰਨ 'ਤੇ ਬਹੁਤ ਝਿਜਕਦੇ ਹਨ ਲੋਕੀ ਆਪਣਾ ਓਟੀਪੀ ਜਾਂ ਆਪਣੇ ਬੈਂਕ ਦੀ ਜਾਣਕਾਰੀ ਵੀ ਸਾਂਝਾ ਕਰ ਦਿੰਦੇ ਹਨ ਜਿਹਨਾਂ ਕਰਕੇ ਉਹ ਸਾਈਬਰ ਧੋਖਾਧੜੀ ਦਾ ਸ਼ਿਕਾਰ ਹੋ ਜਾਂਦੇ ਹਨ ਅਤੇ ਤੀਜੀ ਜਿਹੜੀ ਚੁਨੌਤੀ ਹੈ ਉਹ ਬੈਂਕ ਵਿੱਚ ਮਹਿਲਾ ਕਰਮਚਾਰੀ ਵੀ ਬਹੁਤ ਘੱਟ ਹਨ ਅਤੇ ਆਹ ਵਿੱਤੀ ਲੈਂਡਸਕੇਪ ਵਿੱਚ ਪ੍ਰਤਿਯੋਗੀ ਬਣੇ ਰਹਿਣ ਲਈ ਬੈਂਕਾਂ ਨੂੰ ਬੇਸਲ ਗਾਈਡਲਾਈਨਜ ਦੀ ਪਾਲਣਾ ਕਰਨੀ ਚਾਹੀਦੀ ਹੈ ਆਪਣੇ ਗਰਾਕਾਂ ਨੂੰ ਵੱਧ ਤੋਂ ਵੱਧ ਜਾਣਕਾਰੀ ਦੇਣੀ ਚਾਹੀਦੀ ਹੈ ਅਤੇ ਅਗਾਹ ਕਰਨਾ ਚਾਹੀਦਾ ਹੈ ਕਿ ਕਿਹੜੀ ਜਾਣਕਾਰੀ ਉਹਨਾਂ ਨੂੰ ਸਾਂਝੀ ਕਰਨੀ ਚਾਹੀਦੀ ਹੈ ਅਤੇ ਕਿਹੜੀ ਜਾਣਕਾਰੀ ਉਹਨਾਂ ਨੂੰ ਸਾਂਝੀ ਨਹੀਂ ਕਰਨੀ ਚਾਹੀਦੀ ਹੈ